ਸਤਿ ਸ਼੍ਰੀ ਅਕਾਲ ਮੇਰਾ ਨਾਮ ਕੋਮਲਪ੍ਰੀਤ ਕੌਰ ਹੈ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਬਹੁਤ ਹੀ ਗੰਭੀਰ ਮੁੱਦੇ ਉੱਤੇ ਵਾਰਤਾਲਾਪ ਕਰਨ ਜਾ ਰਹੀ ਹਾਂ ਵਿਸ਼ੇ ਦਾ ਨਾਮ ਹੈਗਾ ਕੁਝ ਇਹੋ ਜਿਹੇ ਵਹਿਮਾਂ ਭਰਮਾਂ ਬਾਰੇ ਗੱਲ ਕੀਤੀ ਜਾਵੇ ਜਿਹਨਾਂ ਦੇ ਉੱਤੇ ਅੱਜ ਕੱਲ੍ਹ ਦੇ ਲੋਕ ਅਸੀਂ ਸਾਡੇ ਆਸ ਪੜੋਸ ਦੇ ਲੋਕ ਬਹੁਤ ਹੀ ਵਧੀਆ ਤਰੀਕੇ ਨਾਲ ਵਿਸ਼ਵਾਸ ਕਰਦੇ ਨੇ ਬਹੁਤ ਹੀ ਮਜਬੂਤੀ ਨਾਲ ਵਿਸ਼ਵਾਸ ਕਰਦੇ ਨੇ ਅਤੇ ਮੈਂ ਇਹ ਵਹਿਮ ਬਾਰੇ ਗੱਲ ਕਰਨਾ ਚਾਹਵਾਂਗੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਆਪਾਂ ਕਿਤੇ ਸ਼ੁਭ ਕੰਮ ਕਰਨ ਵਾਸਤੇ ਜਾ ਰਹੇ ਹੁੰਦੇ ਆ ਤਾਂ ਕਿਹਾ ਜਾਂਦਾ ਅਗਰ ਆਪਾਂ ਅੱਗੇ ਛਿੱਕ ਮਾਰ ਦਿੱਤੀ ਅਤੇ ਕੰਮ ਅਪਸ਼ਗੁਨ ਹੋ ਜਾਣਾ ਜਿਸ ਕੰਮ ਨੂੰ ਆਪਾਂ ਚੱਲੇ ਹਾਂ ਉਹ ਸਿਰੇ ਨਹੀਂ ਚੜਿਆ ਜਾਏਗਾ ਅਤੇ ਇਹ ਵਹਿਮ ਹੈਗਾ ਜੋ ਕਿ ਅਸੀਂ ਤਾਂ ਮੰਨਦੇ ਹੀ ਮੰਨਦੇ ਹਾਂ ਮੈਨੂੰ ਲੱਗਦਾ ਸਾਡੇ ਆਸ ਪੜੋਸ 'ਚ ਸਾਰੇ ਇਸ ਵਹਿਮ ਨੂੰ ਮੰਨਦੇ ਆ ਸਾਨੂੰ ਕਿਉਂਕਿ ਸਾਡੇ ਵੱਡੇ ਬਜ਼ੁਰਗ ਕਹਿੰਦੇ ਆਏ ਆ ਅਤੇ ਦੂਜੇ ਵਹਿਮ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਦੂਜਾ ਵਹਿਮ ਇਹ ਹੈਗਾ ਕਿ ਸੂਰਜ ਢਲੇ ਵੇਲੇ ਆਪਾਂ ਝਾੜੂ ਨਹੀਂ ਫੇਰਨਾ ਕਰ ਦੇ ਵਿੱਚ ਅਤੇ ਕਿਹਾ ਜਾਂਦਾ ਇੰਨਾਂ ਅਸੀਂ ਦਿਨ 'ਚ ਜਿੰਨੀ ਵੀ ਕਮਾਈ ਕੀਤੀ ਆ ਉਹ ਸਾਰੀ ਅਸੀਂ ਖੂਹ 'ਚ ਪਾ ਦਿੱਤੀ ਹੈ ਘਰੋਂ ਸੁੰਬਰ ਦਿੱਤੀ ਹੈ ਘਰੋਂ ਬਾਹਰ ਕੱਢ ਤੀ ਲਕਸ਼ਮੀ ਸਾਡੇ ਦਿਨ ਦੀ ਜਿੰਨੀ ਵੀ ਮਿਹਨਤ ਹੈਗੀ ਆ ਅਤੇ ਇਹ ਹੈ ਤੁਸੀਂ ਕੁਛ ਵਹਿਮ ਭਰਮ ਨੇ ਜਿਹਨਾਂ ਦੇ ਉੱਤੇ ਮੈਨੂੰ ਲੱਗਦਾ ਅਸੀਂ ਅਤੇ ਬਾਕੀ ਲੋਕ ਸਾਰੇ ਬਹੁਤ ਮਜ਼ਬੂਤੀ ਦੇ ਨਾਲ ਵਿਸ਼ਵਾਸ ਕਰਦੇ ਹਨ